ਅੰਮ੍ਰਿਤਸਰ ਜ਼ਿਲ੍ਹੇ ਵਿੱਚ ਮੁੱਖ ਉਦਯੋਗ ਅਤੇ ਆਰਥਿਕ ਚਾਲਕ ਵਿੱਚ ਖੇਤੀਬਾੜੀ ਪਹਿਲੇ ਨੰਬਰ 'ਤੇ ਆਉਂਦੀ ਹੈ ਅੰਮ੍ਰਿਤਸਰ ਜ਼ਿਲ੍ਹੇ ਦੇ ਕਈ ਹਿੱਸਿਆਂ ਵਿੱਚ ਖੇਤੀਬਾੜੀ ਕੀਤੀ ਵੀ ਜਾਂਦੀ ਹੈ ਅੰਮ੍ਰਿਤਸਰ ਜ਼ਿਲ੍ਹੇ ਵਿੱਚ ਮੁੱਖ ਉਦਯੋਗ ਅਤੇ ਆਰਥਿਕ ਚਾਲਕ ਵਿੱਚ ਖੇਤੀਬਾੜੀ ਦੇ ਪਹਿਲੇ ਨੰਬਰ 'ਤੇ ਹੋਣ ਦਾ ਕਾਰਨ ਇੱਧਰ ਦਾ ਜਲਵਾਯੂ ਹੈ ਅੰਮ੍ਰਿਤਸਰ ਦੇ ਕਈ ਹਿੱਸਿਆਂ ਵਿੱਚ ਖੇਤੀਬਾੜੀ ਵਿੱਚ ਕਣਕ ਅਤੇ ਝੋਨਾ ਦੀ ਮੁੱਖ ਤੌਰ 'ਤੇ ਖੇਤੀ ਕੀਤੀ ਜਾਂਦੀ ਹੈ ਅੰਮ੍ਰਿਤਸਰ ਜ਼ਿਲ੍ਹੇ ਕਈ ਹੋਰ ਜ਼ਿਲ੍ਹਿਆਂ ਅਤੇ ਸਟੇਟਾਂ ਵਿੱਚ ਕਣਕ ਅਤੇ ਝੋਨਾ ਨਿਰਯਾਤ ਵੀ ਕਰਦਾ ਹੈ ਅੰਮ੍ਰਿਤਸਰ ਜ਼ਿਲ੍ਹੇ ਵਿੱਚ ਕਈ ਫੈਕਟਰੀਆਂ ਅਤੇ ਫਰਮਾਂ ਵੀ ਹਨ ਜਿਹਨਾਂ ਵਿੱਚ ਉੱਨ ਦੀਆਂ ਵਸਤੂਆਂ ਬਣਾਈਆਂ ਜਾਂਦੀਆਂ ਹਨ ਜਿਵੇਂ ਕਿ ਸ਼ੋਲਾਂ ਅਤੇ ਕੰਬਲ ਇੱਧਰੋਂ ਕਈ ਸਟੇਟਾਂ ਵਿੱਚ ਕੰਬਲ ਦਾ ਨਿਰਯਾਤ ਵੀ ਕੀਤਾ ਜਾਂਦਾ ਹੈ ਅੰਮ੍ਰਿਤਸਰ ਜ਼ਿਲ੍ਹੇ ਦੇ ਕਈ ਹਿੱਸਿਆਂ ਵਿੱਚ ਹੈਨਰੀ ਕਰਾਫਟ ਚੀਜ਼ਾਂ ਵੀ ਬਣਾਈਆਂ ਜਾਂਦੀਆਂ ਹਨ ਜਿਵੇਂ ਕਿ ਪੰਜਾਬੀ ਜੁੱਤੀਆਂ ਅਤੇ ਫੁੱਲਕਾਰੀ ਦੀਆਂ ਸ਼ੋਲਾਂ ਇੱਥੇ ਉਹਦੇ ਕਈ ਇੱਥੇ ਆ ਕੇ ਕਈ ਟੂਰਿਸਟ ਇੱਥੋਂ ਸਮਾਨ ਵੀ ਲੈ ਕੇ ਜਾਂਦੇ ਹਨ ਧੰਨਵਾਦ